ਟੈਕਸ ਦੇ ਵਿੱਚ ਬਦਲਾਅ ਦੇ ਨਾਲ ਪੰਜਾਬ ਸਰਕਾਰ ਨੇ ਕਾਰੋਬਾਰੀਆਂ ਨੂੰ ਕਾਰੋਬਾਰ ਕਰਨ ਦੇ ਵਿੱਚ ਅਸਾਨੀ ਪ੍ਰਦਾਨ ਕੀਤੀ ਹੈ ਚੁੰਗੀ ਦੇ ਹਟਾਉਣ ਦੇ ਨਾਲ ਕਾਰੋਬਾਰ ਦੇ ਵਿੱਚ ਵਾਧਾ ਹੋਇਆ ਹੈ ਇਸ ਨਾਲ ਕਾਰੋਬਾਰੀਆਂ ਦੇ ਉੱਤੇ ਟੈਕਸ ਦਾ ਬੋਝ ਘਟਿਆ ਹੈ ਪੰਜਾਬ ਸਰਕਾਰ ਨੇ ਟੈਕਸ ਦੇ ਵਿੱਚ ਬਦਲਾਅ ਦੇ ਨਾਲ ਕੰਮਕਾਰ ਨੂੰ ਆਸਾਨ ਬਣਾ ਦਿੱਤਾ ਹੈ ਇਸ ਨਾਲ ਛੋਟੇ ਕਾਰੋਬਾਰੀ ਦੇ ਲਈ ਟੈਕਸ ਦੇ ਵਿੱਚ ਛੋਟ ਦਿੱਤੀ ਗਈ ਹੈ ਤਾਂ ਕਿ ਉਸ ਉੱਪਰ ਟੈਕਸ ਦਾ ਬੋਝ ਨਾ ਪਵੇ ਅਤੇ ਜਿਸਦਾ ਵੀ ਕਾਰੋਬਾਰ ਥੋੜ੍ਹਾ ਜ਼ਿਆਦਾ ਹੈ ਉਸਨੂੰ ਟੈਕਸ ਤਿੰਨ ਮਹੀਨੇ ਬਾਅਦ ਜਮ੍ਹਾਂ ਕਰਵਾਉਣਾ ਪੈਂਦਾ ਹੈ ਇਸ ਨਾਲ ਉਸ ਦੇ ਉੱਪਰ ਬੋਝ ਘਟਿਆ ਹੈ ਅਤੇ ਉਸ ਦੇ ਕੰਮਕਾਰ ਦੇ ਵਿੱਚ ਵਾਧਾ ਹੋਇਆ ਹੈ ਇਸ ਦੇ ਨਾਲ ਪੰਜਾਬ ਦੇ ਵਿੱਚ ਆਰਥਿਕ ਵਿਕਾਸ ਦੇ ਵਿੱਚ ਵਾਧਾ ਹੋਇਆ ਹੈ ਅਤੇ ਕੰਮਕਾਰ ਦੇ ਉੱਪਰ ਬਹੁਤ ਜ਼ਿਆਦਾ ਫਰਕ ਪਿਆ ਹੈ ਸਰਕਾਰ ਦੇ ਸਹੀ ਕਦਮਾਂ ਦੇ ਨਾਲ ਪੰਜਾਬ ਦੇ ਵਿੱਚ ਬਿਜਨਸ ਦੇ ਵਿੱਚ ਬਹੁਤ ਹੀ ਫਾਇਦਾ ਹੋਇਆ ਹੈ